ਇੱਕ ਦਿਨ ਮੈਂ ਆਪਣੀ ਦੁਕਾਨ ਤੋਂ ਘਰ ਜਾ ਰਿਹਾ ਸੀ ਰੋਟੀ ਖਾਣ ਵਾਸਤੇ ਅਤੇ ਮੈਂ ਕੀ ਦੇਖਿਆ ਉੱਪਰ ਅਸਮਾਨ ਦੇ ਵਿੱਚ ਬੱਦਲ ਛਾਏ ਹੋਏ ਸੀ ਅਤੇ ਥੋੜ੍ਹਾ ਠੰਡਾ ਜਿਹਾ ਮੌਸਮ ਉੱਤੇ ਹੋਇਆ ਪਿਆ ਸੀ ਜਦੋਂ ਮੈਂ ਜਾ ਰਿਹਾ ਤਾ ਤਾਂ ਅਚਾਨਕ ਬਿਜਲੀ ਵਗੈਰਾ ਕੜਕੀ ਅਤੇ ਥੋੜ੍ਹਾ ਜਿਹਾ ਮੀਂਹ ਪੈਣਾ ਸਟਾਰਟ ਹੋ ਗਿਆ ਮੈਂ ਥੋੜ੍ਹਾ ਗਿੱਲਾ ਹੋਇਆ ਪਰ ਮੈਂ ਸਕੂਟਰੀ ਤੇਜ਼ ਕਰ ਲਈ ਵੀ ਜਲਦੀ ਜਲਦੀ ਆਪਣੇ ਘਰ ਪਹੁੰਚ ਜਾਵਾਂ ਪਰ ਮੈਂ ਥੋੜ੍ਹਾ ਅੱਗੇ ਜਾ ਕੇ ਦੇਖਿਆ ਜਿਵੇਂ ਇੱਕ ਦੋ ਮੋੜ ਮੁੜੇ ਅਤੇ ਅੱਗੇ ਜਾ ਕੇ ਕਿਆ ਦੇਖਿਆ ਜੀ ਇੱਕ ਸਾਈਡ ਧੁੱਪ ਚਮਕ ਰਹੀ ਸੀ ਅਤੇ ਉੱਥੇ ਮੀਂਹ ਨਹੀਂ ਪੈ ਰਿਹਾ ਸੀ ਅਤੇ ਮੈਂ ਉਹ ਖੜ੍ਹਕੇ ਦੇਖਿਆ ਪਿੱਛੇ ਵੀ ਇਕਦਮ ਮੀਂਹ ਕਿੱਥੇ ਗਿਆ ਅਤੇ ਪਿਛਲੀ ਸਾਈਡ ਮੀਂਹ ਪੈ ਰਿਹਾ ਸੀ ਜੋ ਕਿ ਮੈਨੂੰ ਬਹੁਤ ਅਜੀਬ ਜਿਹਾ ਲੱਗਿਆ ਵੀ ਇੱਕ ਸਾਈਡ ਮੀਂਹ ਪੈ ਰਿਹਾ ਅਤੇ ਇੱਕ ਸਾਈਡ ਧੁੱਪ ਨਿਕਲ ਰਹੀ ਹੈ